ਵਿਕਾਸਸ਼ੀਲ ਸੰਸਾਰ ਬਾਰੇ ਤਾਂ ਬਹੁਤ ਬ ਬਹੁਤ ਸਾਰੇ ਵਿਚਾਰ ਹਨ ਮੈਂ ਉਹਨਾਂ ਵਿੱਚੋਂ ਕੁਝ ਕੁ ਬਾਰੇ ਬੋਲਣਾ ਚਾਹੂੰਗੀ ਕਿਉਂਕਿ ਮੈਨੂੰ ਲੱਗਦਾ ਹੈ ਕਿ ਦੁਨੀਆ ਬਹੁਤ ਜ਼ਿਆਦਾ ਬਦਲ ਗਈ ਹੈ ਕਿਉਂਕਿ ਹੁਣ ਜੇ ਤੁਸੀਂ ਕਿਸੇ ਦੇ ਨਾਲ ਵੀ ਤੁਸੀਂ ਇੱਕ ਅ ਦੇਸ਼ ਵਿੱਚ ਬੈਠੇ ਹੋ ਅਤੇ ਤੁਸੀਂ ਦੂਜੀ ਦੇਸ਼ ਦੇ ਵਿੱਚ ਕਿਸੇ ਦੇ ਨਾਲ ਵੀ ਗੱਲ ਕਰਨੀ ਹੈ ਤਾਂ ਬਹੁਤ ਹੀ ਜ਼ਿਆਦਾ ਆਸਾਨ ਹੋ ਗਈ ਹੈ ਕਿਉਂਕਿ ਪਹਿਲੇ ਸਮਿਆਂ ਦੇ ਵਿੱਚ ਚਿੱਠੀਆਂ ਦੇ ਨਾਲ ਜਿਹੜਾ ਆ ਇੱਕ ਦੂਜੇ ਦੇ ਨਾਲ ਗੱਲਬਾਤ ਕੀਤੀ ਜਾਂਦੀ ਸੀ ਕਿਤੇ ਚਿੱਠੀਆਂ ਪਹੁੰਚਣ ਵਿੱਚ ਬਹੁਤ ਜ਼ਿਆਦਾ ਸਮਾਂ ਲੈਂਦੀਆਂ ਸੀ ਬਟ ਅੱਜ ਕੱਲ੍ਹ ਕਮਨੀਕੇਸ਼ਨ ਇੰਨੀ ਜ਼ਿਆਦਾ ਵਧੀਆ ਹੋ ਗਈ ਹੈ ਕਿ ਤੁਸੀਂ ਇੱਕ ਜਗ੍ਹਾ 'ਤੇ ਬੈਠੇ ਹੋਏ ਸੰਸਾਰ ਦੂਜੇ ਦੇਸ਼ ਵਿੱਚ ਕਿਸੇ ਦੇ ਨਾਲ ਵੀ ਗੱਲ ਕਰ ਸਕਦੇ ਹੋ ਦੇਖ ਸਕਦੇ ਹੋ ਉਹਨਾਂ ਨੂੰ ਅਤੇ ਉਹਨਾਂ ਨਾਲ ਤੁਸੀਂ ਬਹੁਤ ਸਾਰੀਆਂ ਗੱਲਾਂ ਕਰ ਸਕਦੇ ਹੋ ਜਿਹੜੀਆਂ ਕਿ ਪਹਿਲਾਂ ਜਿਹੜੀਆਂ ਆ ਉਹ ਆਸਾਨ ਨਹੀਂ ਸੀ ਕਰਨੀਆਂ ਇਹਦੇ ਤੋਂ ਬਿਨਾਂ ਅੱਜ ਕੱਲ੍ਹ ਗਲੋਬ ਗਲੋਬਲਾਈਜੇਸ਼ਨ ਦਾ ਜ਼ਮਾਨਾ ਹੈ ਕਿ ਤੁਹਾਨੂੰ ਪਹਿਲਾਂ ਤੁਹਾਨੂੰ ਜਿਹੜੀਆਂ ਬਾਹਰਲੀਆਂ ਚੀਜ਼ਾਂ ਹੈ ਉਹ ਇੰਨੀ ਜਲਦੀ ਨਹੀਂ ਮਿਲਦੀਆਂ ਸੀਗੀਆਂ ਅਤੇ ਹੁਣ ਤੁਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਕ ਦੁਨੀਆਂ ਦੇ ਹੋਰ ਕਿਸੇ ਦੇ ਵੀ ਕੋਨੇ ਦੇ ਵਿੱਚੋਂ ਜਿਹੜੀਆਂ ਚੀਜ਼ਾਂ ਹੈ ਉਹ ਮੰਗਵਾ ਸਕਦੇ ਹਾਂ ਅਤੇ ਇਹ ਤੋਂ ਬਿਨਾਂ ਜਿਹੜਾ ਆ ਕਿ ਬਿਜ਼ਨਸ ਕਰਨਾ ਵੀ ਬਹੁਤ ਹੀ ਜ਼ਿਆਦਾ ਆਸਾਨ ਹੋ ਗਿਆ ਆ ਹੁਣ ਤੁਸੀਂ ਇੱਕ ਕੰਟਰੀ ਤੋਂ ਬੈਠੇ ਅਲੱਗ ਇੱਕ ਕੰਟਰੀ ਦੇ ਵਿੱਚ ਬੈਠੇ ਹੋਏ ਅਲੱਗ ਅਲੱਗ ਕੰਟਰੀ ਦੇ ਵਿੱਚ ਜਿਹੜਾ ਆਪਣਾ ਬਿਜ਼ਨਸ ਆ ਉਹ ਵਧੀਆ ਢੰਗ ਨਾਲ ਚਲਾ ਸਕਦੇ ਹਾਂ ਤਾਂ ਇਹਦੇ ਕਰਕੇ ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਜਿਹੜੀ ਆ ਦੁਨੀਆ ਬਹੁਤ ਜ਼ਿਆਦਾ ਬਦਲ ਗਈ ਹੈ ਜੇ ਅਸੀਂ ਇਹਨਾਂ ਨੂੰ ਪੁਰਾ ਪੁਰਾਣੇ ਜ਼ਮਾਨੇ ਦੇ ਨਾਲ ਦੇਖੀਏ ਤਾਂ ਅੱਜ ਕੱਲ੍ਹ ਦੁਨੀਆ ਜਿਹੜੀ ਆ ਉਹ ਕਾਫੀ ਜ਼ਿਆਦਾ ਬਦਲ ਚੁੱਕੀ ਹੈ